ਹਾਂ ਸਾਡੇ ਖੇਤਰ ਵਿੱਚ ਬਹੁਤ ਇਤਿਹਾਸਿਕ ਕਿਲ੍ਹੇ ਅਤੇ ਮੰਦਰ ਹਨ ਜਿਵੇਂ ਮੰਦਰ ਹਨ ਜਿਵੇਂ ਕਿ ਦਰਬਾਰ ਸਾਹਿਬ ਕਿਲ੍ਹਾ ਮੁਬਾਰਕ ਅਤੇ ਹੋਰ ਵੀ ਇਤਿਹਾਸਿਕ ਅਸਥਾਨ ਹਨ ਜਿਹਨਾਂ ਦਾ ਦੌਰਾ ਮੈਂ ਬਹੁਤ ਵਾਰੀ ਕੀਤਾ ਹੈ ਇਸ ਥਾਵਾਂ 'ਤੇ ਜਾਣਾ ਮੈਨੂੰ ਬਹੁਤ ਵਧੀਆ ਲੱਗਦਾ ਹੈ ਕਿਉਂਕਿ ਇਸ ਨਾਲ ਮੇਰੀ ਜਾਣਕਾਰੀ ਵ ਵੱਧਦੀ ਹੈ ਅਤੇ ਮੈਨੂੰ ਆਪਣੇ ਇਤਿਹਾਸ ਬਾਰੇ ਪਤਾ ਲੱਗਦਾ ਹੈ